ਅੱਜਕੱਲ੍ਹ ਦਾ ਯੁੱਗ ਹੀ ਟੈਕਨੋਲਜੀ ਦਾ ਯੁੱਗ ਹੈ ਅਤੇ ਅਸੀਂ ਮੰਨਦੇ ਹਾਂ ਕਿ ਟੈਕਨੋਲਜੀ ਬਾਰੇ ਲੀਅਰਿੰਗ ਕਰਨਾ ਸਭ ਲਈ ਅਧਿਐਨ ਕਰਨ ਲਈ ਇੱਕ ਬੁਨਿਆਦੀ ਵਿਸ਼ਾ ਹੋਣਾ ਚਾਹੀਦਾ ਹੈ ਇੱਕ ਦੁਨਿਆਵੀ ਵਿਸ਼ਾ ਨਹੀਂ ਹੋਣਾ ਚਾਹੀਦਾ ਜਿਸ ਵੀ ਇਨਸਾਨ ਨੂੰ ਟੈਕਨੋਲਜੀ ਦੀ ਰੇ ਲੋੜ ਹੈ ਉਸਨੂੰ ਉਸ ਬਾਰੇ ਜ਼ਰੂਰ ਸਿਖਾਉਣਾ ਚਾਹੀਦਾ ਹੈ ਪਰ ਜਿਸ ਇਨਸਾਨ ਨੂੰ ਟੈਕਨੋਲਜੀ ਦੀ ਕੋਈ ਜ਼ਰੂਰਤ ਨਹੀਂ ਹੈ ਉਸ ਨੂੰ ਸਿੱਖਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈ ਕਿਉਂਕਿ ਟੈਕਨੋਲਜੀ ਦੇ ਬਹੁਤ ਹੀ ਜ਼ਿਆਦਾ ਨੁਕਸਾਨ ਵੀ ਹਨ ਜੇ ਆਪਾਂ ਉਸਦੇ ਫਾਇਦਿਆਂ ਦੀ ਗੱਲ ਨੂੰ ਦੇਖੀਏ ਇਕੱਲਿਆਂ ਨੂੰ ਤਾਂ ਉਹ ਦੇਖਣਾ ਇੱਕ ਨਾ ਸਮਝੀ ਹੈ ਕਿਉਂਕਿ ਟੈਕਨੋਲਜੀ ਦਾ ਬਹੁਤ ਜ਼ਿਆਦਾ ਗ਼ਲਤ ਅਸਰ ਆਪਣੇ ਮਨ ਅਤੇ ਤਨ 'ਤੇ ਪੈਂਦਾ ਹੈ ਤਾਂ ਮੇਰੇ ਹਿਸਾਬ ਦੇ ਨਾਲ ਟੈਕਨੋਲਜੀ ਬਾਰੇ ਲੀਅਰਿੰਗ ਕਰਨਾ ਸਭ ਲਈ ਅਧਿਐਨ ਕਰਨ ਲਈ ਇੱਕ ਬੁਨਿਆਦੀ ਵਿਸ਼ਾ ਹੀ ਹੋਣਾ ਚਾਹੀਦਾ ਹੈ ਇਹ ਇੱਕ ਦੁਨਿਆਵੀ ਵਿਸ਼ਾ ਨਹੀਂ ਹੋਣਾ ਚਾਹੀਦਾ